ਕੋਵਿਡ ਮਹਾਂਮਾਰੀ ਜੋ ਕਿ ਮਾਰਚ ਦੋ ਹਜ਼ਾਰ ਵੀਹ ਵਿੱਚ ਆਈ ਸੀ ਉਸ ਤੋਂ ਪਹਿਲਾਂ ਸਾਡੇ ਖੇਤਰ ਵਿੱਚ ਬਹੁਤ ਹੀ ਚਹਿਲ ਪਹਿਲ ਰਹਿੰਦੀ ਸੀ ਅਤੇ ਰੁਜ਼ਗਾਰ ਦੇ ਬਹੁਤ ਹੀ ਮੌਕੇ ਹੁੰਦੇ ਸਨ ਪਰ ਕੋਵਿਡ ਮਹਾਂਮਾਰੀ ਦੇ ਦੌਰਾਨ ਸੈਰ ਸਪਾਟੇ ਦੀਆਂ ਜਗ੍ਹਾਵਾਂ ਨੂੰ ਤਾਲਾ ਹੀ ਲੱਗ ਗਿਆ ਸੀ ਜਿਸ ਕਰਕੇ ਹੁਣ ਤੱਕ ਉਸ ਦੀ ਭਰਭਾਈ ਨਹੀਂ ਹੋਈ ਅਤੇ ਰੁਜ਼ਗਾਰ ਦੇ ਮੌਕੇ ਵੀ ਬਹੁਤ ਘੱਟ ਗਏ ਹਨ ਤਾਂ ਮੈਂ ਇਹੀ ਕਹਾਂਗਾ ਕਿ ਕੋਵਿਡ ਨੇ ਸਾਡੇ ਜ਼ਿਲ੍ਹੇ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਅਤੇ ਬਹੁਤ ਹੀ ਬੇਰੁਜ਼ਗਾਰੀ ਦਾ ਪੱਧਰ ਵਧਾਇਆ ਹੈ ਇਹ ਘਾਟਾ ਪਤਾ ਨਹੀਂ ਕਦੋਂ ਪੂਰਾ ਹੋਵੇਗਾ ਅਤੇ ਸੈਰ ਸਪਾਟੇ ਦੀਆਂ ਜਗ੍ਹਾਵਾਂ ਵਿੱਚ ਵੀ ਭਾਰੀ ਸੈਲਾਨੀਆਂ ਦੀ ਗਿਰਾਵਟ ਆਈ ਹੈ